ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਮਾਨਸੀ ਹੈ ਕੀ ਮੇਰੀ ਗੱਲ ਸ਼ੇਰ ਏ ਪੰਜਾਬ ਢਾਬੇ ਦੇ ਚੇਅਰਮੈਨ ਮਨਦੀਪ ਸਿੰਘ ਨਾਲ਼ ਹੋ ਰਹੀ ਹੈ ਤੁਹਾਨੂੰ ਪਤਾ ਹੀ ਹੈ ਅਕਸਰ ਮੈਂ ਇੱਥੋਂ ਹੀ ਔਡਰ ਬੁੱਕ ਕਰਦੀ ਹਾਂ ਸੋ ਥੋੜ੍ਹੀ ਦੇਰ ਪਹਿਲਾਂ ਮੈਂ ਆਪਣਾ ਔਡਰ ਬੁੱਕ ਕੀਤਾ ਸੀ ਕੜਾਹੀ ਪਨੀਰ ਤਿੰਨ ਦੋ ਦਾਲ ਮੱਖਣੀ ਮਿਕਸ ਰਾਇਤਾ ਬੂੰਦੀ ਰਾਇਤਾ ਪੰਦਰ੍ਹਾਂ ਬਟਰ ਰੋਟੀ ਅਤੇ ਤੁਹਾਡਾ ਸਪੈਸ਼ਲ ਅਤੇ ਸਲਾਦ ਮੈਂ ਤੁਹਾਨੂੰ ਇਹ ਕ ਕਹਿਣ ਲਈ ਫੋਨ ਕੀਤਾ ਸੀ ਕਿ ਅੱਜ ਸਾਡੇ ਘਰ ਮਹਿਮਾਨ ਆ ਰਹੇ ਹਨ ਤਾਂ ਤੁਹਾਡਾ ਜਿਹੜਾ ਸਪੈਸ਼ਲ ਆਚਾਰ ਹੈ ਉਹ ਸਭ ਨੂੰ ਬਹੁਤ ਪਸੰਦ ਆਉਂਦਾ ਹੈ ਕਿ ਤੁਸੀਂ ਉਹ ਆਚਾਰ ਥੋੜ੍ਹਾ ਜਿਹਾ ਜ਼ਿਆਦਾ ਭੇਜ ਸਕਦੇ ਹੋ ਤਾਂ ਕਿ ਸਾਡੇ ਸਾਰੇ ਰਿਸ਼ਤੇਦਾਰ ਖੁਸ਼ ਹੋ ਸਕਣ ਸਾਨੂੰ ਸਾਡੇ ਘ ਸਾਰੀ ਫੈਮਲੀ ਨੂੰ ਤੁਹਾਡੇ ਢਾਬੇ 'ਤੇ ਬਹੁਤ ਵਧੀਆ ਲੱਗਦਾ ਹੈ ਅਸੀਂ ਇੱਥੇ ਹੀ ਅਕਸਰ ਆਉਂਦੇ ਜਾਂਦੇ ਰਹਿੰਦੇ ਹਾਂ ਅਤੇ ਇੱਕ ਹੋਰ ਹੈਲਪ ਚਾਹੀਦੀ ਸੀ ਤੁਹਾਡੀ ਕਿ ਸ ਮੇਰੇ ਕੋਲ ਅੱਜ ਕੈਸ਼ ਥੋੜ੍ਹਾ ਜਿਹਾ ਘੱਟ ਹੈ ਕੀ ਤੁਸੀਂ ਆਪਣਾ ਗੂਗਲ ਪੇ ਰਾਹੀਂ ਪੇਮੈਂਟ ਕਰ ਸਕਦੇ ਹੋ ਤੁਸੀਂ ਆਪਣੇ ਡਿਲੀਵਰੀ ਬੋਆਏ ਦੇ ਨਾਲ ਕੋਡ ਭੇਜ ਦਿਓ ਮੈਂ ਉਹਦੇ ਨਾਲ ਹੀ ਔਡਰ ਕਰ ਦੇਵਾਂਗੀ ਅਤੇ ਬਾਕੀ ਗੱਲ ਕਰੀਏ ਤੁਹਾਡੇ ਢਾਬੇ ਦੀ ਤੁਹਾਡਾ ਢਾਬਾ ਬਹੁਤ ਜ਼ਿਆਦਾ ਵਧੀਆ ਹੈ ਇੱਥੇ ਖਾਣ ਪੀਣ ਲਈ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਵਧੀਆ ਹੈ ਸਾਨੂੰ ਇੱਥੇ ਆਉਣ ਵਿੱਚ ਬਹੁਤ ਖੁਸ਼ੀ ਹੁੰਦੀ ਹੈ ਅਤੇ ਇੱਥੇ ਦੀ ਸਰਵਿਸ ਵੀ ਬਹੁਤ ਜ਼ਿਆਦਾ ਵਧੀਆ ਹੈ